ਇੰਟਰਨੈ ਨੇ ਐਨਾ ਵੀ ਨੈੱਟ ਨੇ ਜੋ ਆਪਣਾ ਤੈਕਨੋਲਜੀ ਹੈ ਇਹ ਬਹੁਤ ਵਧੀਆ ਹੈ ਕਿਉਂਕਿ ਮੈਂ ਆਪਣੇ ਫੋਨ ਤੋਂ ਕਿਸੇ ਦਾ ਕਿਸੇ ਨੂੰ ਪੇਮੈਂਟ ਆਪਣਾ ਕਰਨੀ ਜਾਂ ਕਿਸੇ ਤੋਂ ਪੇਮੈਂਟ ਲੈਣੀ ਮੈਂ ਆਪਣੇ ਫੋਨ ਤੋਂ ਕਿਸੇ ਨੂੰ ਭੇਜ ਵੀ ਆਪਣਾ ਦਿੰਦਾ ਹਾਂ ਅਤੇ ਉਸ ਤੋਂ ਲੈ ਵੀ ਲੈ ਲੈ ਵੀ ਲੈਂਦਾ ਹਾਂ ਜੋ ਕਿ ਇੱਕ ਬਹੁਤ ਵਧੀਆ ਹੈ ਇੰਟਰਨਮੇ ਨੈ ਵੀ ਨੈਟ ਅੱਛਾ ਇਹਦੇ ਨਾਲ ਹੀ ਸਾਨੂੰ ਬਹੁਤ ਆਸਾਨ ਹੁੰਦਾ ਹੈ